ਹੈਲੋ ਸਤਿ ਸ਼੍ਰੀ ਅਕਾਲ ਦੀਦੀ ਕਿਵੇਂ ਹੋ ਕੀ ਕਰਦੇ ਹੋ ਮੈਂ ਤਾਂ ਆਪ ਵਿਹਲੀ ਹਾਂ ਹੋਰ ਦੀਦੀ ਦੀਦੀ ਬ ਮੈਂ ਤਾਂ ਕਹਿੰਦੀ ਹਾਂ ਵੀ ਆਪਾਂ ਇੱਥੇ ਵੇਖ ਲੈਂਦੇ ਜਾਂ ਬੈਂਕ ਦੀ ਇਹਨਾਂ ਟੀਚਰਾਂ ਦੀ ਜੋਬ ਵਾਹ ਵਾਹ ਨਿਕਲੀਆਂ ਹੋਈਆਂ ਹੁਣ ਤਾਂ ਨਿਕਲੀ ਵੀ ਹੋਈ ਹੈਗੀ ਹੁਣ ਕੱਲ੍ਹ ਪਰਸੋਂ ਵੀ ਉਹ ਪੇਪਰ ਜਿਹਾ ਹੋਇਆ ਸੀ ਹੁਣ ਫਿਰ ਹੋਣਾ ਦਿੰਦੇ ਹਾਂ ਇਹ ਤਾਂ ਗੱਲ ਸਹੀ ਹੈ ਦੀਦੀ ਹਾਂ ਪ੍ਰਾਈਵੇਟ ਪੰਜ ਹੀ ਹੁੰਦਾ ਪੰਜ ਤੋਂ ਵੱਧ ਲੈਂਦੇ

ਹੁੰ ਇਹ ਤਾਂ ਹੈ ਨਹੀਂ ਆਪ ਐਂ ਬੈਂਕ ਦਾ ਤਾਂ ਦੀਦੀ ਫਿਰ ਇਹ ਵੀ ਜੇ ਆਪਣੀ ਸੈਲਰੀ ਵੀ ਘੱਟ ਹੋਈ ਫਿਰ ਉਹਦਾ ਆਪਾਂ ਨੂੰ ਬੋਨਸ ਆ ਜਾਣਾ ਦਿਵਾਲੀ 'ਤੇ ਪੰਜਾਹ ਪੰਜਾਹ ਹਜ਼ਾਰ ਸੱਠ ਸੱਠ ਹਜ਼ਾਰ ਦਿੰਦੇ ਆ ਉਹ ਸੈਲਰੀ ਹਿਸਾਬ ਨਾਲ ਹਾਂ ਪ੍ਰਾਈਵੇਟ ਵੀ ਇੰਨਾ ਹੀ ਦਿੰਦੇ ਆ ਇੱਦਾਂ ਹੁੰਦਾ ਗਾ ਵੀ ਇਹਦੇ ਵਿੱਚ ਕਿ ਜਿੰਨੀ ਆਪਣੀ ਸੈਲਰੀ ਮੰਨ ਕੇ ਚੱਲੋ ਆਪਣੇ ਲੱਗਦੇ ਪੰਦਰਾਂ ਵੀਹ ਮਿਲੀ ਆ ਆਪਾਂ ਨੂੰ ਸੈਲਰੀ ਹੈ ਨਾ ਤਾਂ ਫਿਰ ਆਪਾਂ ਨੂੰ ਚਾਲੀ ਹਜ਼ਾਰ ਬੋਨਸ ਆਵੇਗਾ ਨਾਲ ਘਰ ਦੇਖੋ ਕਹਿੰਦੀ ਜੀ ਸੈਲਰੀ ਬੈਂਕ 'ਚ ਘੱਟ ਹੋਈ ਤਾਂ ਆਪਾਂ ਨੂੰ ਦੁੱਖ ਨਹੀਂ ਗਾ ਹੋਰ ਘਰ ਬਹਿ ਐਂ ਹੁੰਦਾ ਵੀ ਇੰਨਾ ਪੈਸਾ ਲਗਾਇਆ ਪੜ੍ਹਾਈ 'ਤੇ ਉਹ ਤਾਂ ਪੂਰਾ ਕਰੀਏ ਹਾਂ ਮੈਡੀਕਲ 'ਚ ਵੀ ਹੈਗਾ ਹਾਂ ਦੀਦੀ ਪਤਾ ਕਿਆ ਆਪਣੇ ਜੋਬ ਦਾ ਵਾਧੂ ਹੈਗੇ ਨੌਕਰੀਆਂ ਦਾ ਆਪਣੇ ਇੱਥੇ ਸਕੂਲ 'ਚ ਹੋ ਗਈਆਂ ਮੈਡੀਕਲ 'ਚ ਹੋ ਗਈਆਂ ਅਤੇ ਆਪਣੇ ਬੈਂਕਾਂ 'ਚ ਹੋ ਗਈਆਂ ਪਰ ਉਹ ਹੀ ਆ ਹੁਣ ਆਪਾਂ ਜਾਵਾਂਗੇ ਰੱਖ ਤਾਂ ਲੈਣਗੇ ਇੰਟਰਵਿਊ ਹੋਣਗੇ ਪਹਿਲਾਂ ਆਪਣੇ ਪਰ ਹੁਣ ਐਂ ਨਾ ਹੁਣ ਆਪਣੇ ਵਰਗੇ ਤਾਂ ਲੱਗ ਜਾਵੇਗਾ ਬੀਕੌਮ ਕੀਤੀ ਦੀ ਨਾ ਇੰਜੀਨੀਅਰ ਕੀਤੇ ਆ ਉਹ ਵਿਚਾਰੇ ਨਹੀਂ ਕਰਦੇ ਹੁਣ ਮੇਰੇ ਨਾਲ ਆ ਮੇਰੇ ਤਾਏ ਦੀ ਕੁੜੀ ਉਹਨੇ ਕੀਤੀ ਹੈ ਇੰਜੀਨੀਅਰ ਅਤੇ ਹੁਣ ਉਹਨੂੰ ਮਿਲਦੀ ਨੀਗੀ ਆਪਣੇ ਐਡਾ ਵੱਡਾ ਸ਼ਹਿਰ ਨਹੀਂ ਨਾ ਹੈਗਾ ਹੁੰ ਅੱਛਾ ਜੀ ਹਾਂਜੀ ਹਾਂ ਹਾਂ ਵਧੀਆ ਨਾਲੇ ਐਂ ਨਾ ਗਾਈਡ ਕਰਨ ਵਾਲਾ ਬੰਦਾ ਮਿਲ ਜਾਵੇ ਆਪਾਂ ਨੂੰ ਦੱਸਣ ਨਾਲ ਜਾਣਕਾਰੀ ਦੇਣਾ ਫਿਰ ਬਾਹਲਾ ਸੌਖਾ ਹੋ ਜਾਂਦਾ ਅਟਕੀਏ ਹਾਂ ਨਹੀਂ ਐਂ ਕਿ ਆਪਣੇ ਤਾਂ ਨੌਕਰੀਆਂ ਤਾਂ ਵਾਧੂ ਬਸ ਆਪਣੀ ਘੋਲ ਹੋ ਜਾਂਦੀ ਹੈ ਅੱਜ ਜਾਂਦੀ ਹਾਂ ਕੱਲ੍ਹ ਜਾਂਦੀ ਹਾਂ ਹੋਰ ਹਾਂ ਮੈਂ ਦੇਖ ਤੁਸੀਂ ਆਪਣੇ ਉਹਦੇ ਨਾਲ ਗੱਲ ਕਰਿਓ ਨਾ ਹੁੰ ਹੁੰ

ਆਪਣੇ ਤਾਂ ਸੌਖਾ ਹੈਗੇ ਵੀ ਵਾਧੂ ਇੱਥੇ

ਚੱਲ ਕੋਈ ਨਹੀਂ ਫਿਰ ਅੱਜ ਤੁਸੀਂ ਅੱਜ ਉਹਨੂੰ ਪੁੱਛੋ ਜਿਹੜੇ ਤੁਹਾਡੇ ਬੈਂਕ 'ਚ ਲੱਗਿਆ ਮੁੰਡਾ ਫਿਰ ਆਪਾਂ ਗੱਲ ਕਰਕੇ ਫਿਰ ਆਪਾਂ ਚੱਲਦੇ ਹਾਂ ਹੁੰ ਹੁੰ ਕੰਪਿਊਟਰ ਦਾ ਸੀਗਾ ਹਾਂ ਉਹਨਾਂ ਨੇ ਆਪਾਂ ਤਾਂ ਸਾਰਾ ਪਤਾ ਆਪਾਂ ਨੂੰ ਜਾਣਕਾਰੀ ਹੈਗੀ ਨਾਲ ਕੰਮ ਬਾਰੇ ਠੀਕ ਹੈ ਚੱਲ ਗੱਲ ਕਰਕੇ ਦੱਸਿਓ ਠੀਕ ਠੀਕ ਹੈ ਦੀਦੀ